ਨਹੀਂ ਯੋਗਾ ਸਿਰਫ ਕਸਰਤ ਦਾ ਇੱਕ ਰੂਪ ਨਹੀਂ ਹੈ ਇਹ ਹੋਰ ਵੀ ਕੁਛ ਹੈ ਯੋਗਾ ਇੱਕ ਆਸਣ ਹੈ ਜਿਸ ਦੇ ਵਿੱਚ ਕਈ ਸਾਰੇ ਆਸਣ ਆਉਂਦੇ ਹਨ ਅਤੇ ਉਹ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਅਸੀਂ ਆਸਣ ਲੇਟ ਕੇ ਕਰ ਲੈਂਦੇ ਹਾਂ ਪੈ ਕੇ ਠੀਕ ਹੈ ਖੜ੍ਹੇ ਹੋ ਕੇ ਬੈਠ ਕੇ ਅਤੇ ਏਦਾ ਦੇ ਕਈ ਪ੍ਰਕਾਰ ਦੇ ਆਸਣ ਆਉਂਦੇ ਹਨ ਬਸ ਕਸਰਤ ਵਿੱਚ ਸਿਰਫ ਇੱਕ ਕਿਰਿਆ ਹੈ ਜੋ ਕਿ ਅਸੀਂ ਆਮ ਵੀ ਤੁਰਦੇ ਫਿਰਦੇ ਜਾਂ ਖਾਣਾ ਖਾਣ ਤੋਂ ਬਾਅਦ ਕਰ ਲੈਂਦੇ ਹਾਂ ਕਸਰਤ ਅਤੇ ਯੋਗਾ ਦੋਨਾਂ ਵਿੱਚ ਬਹੁਤ ਹੀ ਡਿਫਰੈਂਸ ਹੈ ਪਰ ਦੋਨਾਂ ਦਾ ਨਤੀਜਾ ਇੱਕ ਹੀ ਹੁੰਦਾ ਹੈ ਬਸ ਫਰਕ ਐਨਾ ਹੈ ਕਿ ਯੋਗਾ ਇੱਕ ਅਲੱਗ ਕਿਸਮ ਦੀ ਕਿਰਿਆ ਹੈ ਜਿਸ ਦੇ ਵਿੱਚ ਕਈ ਸਾਰੇ ਆਸਣ ਹੁੰਦੇ ਹਨ ਅਤੇ ਇਹ ਆਸਣ ਅਸੀਂ ਆਮ ਜ਼ਿੰਦਗੀ ਵਿੱਚ ਕਰਦੇ ਰਹਿੰਦੇ ਹਨ ਅਤੇ ਕਸਰਤਾਂ ਹੁੰਦੀਆਂ ਹਨ ਉਹ ਸਿਰਫ਼ ਅਸੀਂ ਕਦੇ ਵੀ ਕਰ ਲੈਂਦੇ ਹਾਂ ਜਿਵੇਂ ਕਿ ਅਸੀਂ ਖਾਣਾ ਖਾਣ ਤੋਂ ਬਾਅਦ ਵੀ ਕਰ ਲੈਂਦੇ ਹਾਂ ਫਿਰ ਬੈਠੇ ਬੈਠੇ ਕਰ ਲੈਂਦੇ ਹਾਂ ਏਦਾ ਅਸੀਂ ਕਸਰਤਾਂ ਕਰਦੇ ਰਹਿੰਦੇ ਹਨ ਕਸਰਤਾਂ ਸਿਰਫ ਇੱਕ ਕਿਰਿਆ ਹੈ ਪਰ ਇਹ ਸਿਰਫ਼ ਦੋਨਾਂ ਦਾ ਕੋਈ ਮੇਲ ਨਹੀਂ ਹੈ ਯੋਗਾ ਅਲੱਗ ਹੈ ਅਤੇ ਕਸਰਤ ਅਲੱਗ ਹੁੰਦੀ ਹੈ